ਪੰਜਾਬ ਦੀਆਂ ਜ਼ਿਆਦਾਤਰ ਟੈਕਨੋਲੋਜੀ ਕੰਪਨੀਆਂ ਮੋਹਾਲੀ ਜ਼ਿਲ੍ਹੇ ਵਿੱਚ ਹਨ ਜਿਵੇਂ ਕਿ ਪਨਕੌਮ ਐਸ ਟੀ ਪੀ ਆਈ ਮੋਹਾਲੀ ਜਾਂ ਫਿਰ ਇੱਕ ਸੋਫਟਵੇਰ ਟੈਕਨੋਲੋਜੀ ਪਾਰਕ ਅੰਮ੍ਰਿਤਸਰ ਵਿਖੇ ਹੈ ਐਸ ਟੀ ਪੀ ਆਈ ਇਨਕੋਮੇਸ਼ਨ ਸੈਂਟਰ ਜਿਹੜਾ ਮੋਹਾਲੀ ਵਿਖੇ ਹੈ ਐਸ ਟੀ ਪੀ ਆਈ ਦੀ ਫੁੱਲ ਫੋਰਮ ਹੈ ਸੋਫਟਵੇਅਰ ਟੈਕਨੋਲੋਜੀ ਪਾਰਕ ਔਫ ਇੰਡੀਆ ਜੋ ਕਿ ਮਨਿਸਟਰੀ ਔਫ ਇਲੈਕਟਰੋਨਿਕਸ ਐਂਡ ਆਈ ਟੀ ਦੇ ਅਧੀਨ ਆਉਂਦਾ ਹੈ ਐਸ ਟੀ ਪੀ ਆਈ ਦੇ ਪੂਰੇ ਭਾਰਤ ਵਿੱਚ ਤ੍ਰੇਂਹਠ ਸੈਂਟਰ ਹਨ ਜਿਨ੍ਹਾਂ ਵਿੱਚੋਂ ਐਸ ਟੀ ਪੀ ਆਈ ਮੋਹਾਲੀ ਇੱਕ ਹੈ ਇਹ ਸੈਂਟਰ ਸਾਡੇ ਭਾਰਤ ਦੇ ਸੋਫਟਵੇਰ ਉਦਯੋਗ ਨੂੰ ਵਧਾਉਣ ਲਈ ਬਹੁਤ ਮਹੱਤਵ ਰੱਖਦੇ ਹਨ ਬਹੁਤ ਸਾਰਾ ਸੋਫਟਵਰ ਸਰਵਿਸ ਦਾ ਐਕਸਪੋਰਟ ਵੀ ਦੂਜੇ ਦੇਸ਼ਾਂ ਨੂੰ ਇਹਨਾਂ ਦੁਆਰਾ ਕੀਤਾ ਜਾਂਦਾ ਹੈ ਪੰਜਾਬ ਨੂੰ ਇਹਨਾਂ ਦਾ ਬਹੁਤ ਫਾਇਦਾ ਹੈ ਕਿਉਂਕਿ ਇਸ ਨਾਲ ਪੰਜਾਬ ਦੇ ਲੋਕਲ ਬੰਦਿਆਂ ਨੂੰ ਇੱਕ ਤਾਂ ਰੁਜ਼ਗਾਰ ਮਿਲਦਾ ਹੈ ਦੂਜਾ ਸੋਫਟਵਰ ਸਰਵਿਸ ਜਾਂ ਡਾਟਾ ਸਰਵਿਸ ਦੀ ਲੋੜ ਨੂੰ ਵੀ ਇਹ ਪੂਰਾ ਕਰਦੇ ਹਨ ਦੂਜਾ ਇੱਕ ਪਨਕੋਮ ਹੈ ਜੋ ਕਿ ਪੰਜਾਬ ਕੋਮਨੀਕੇਸ਼ਨ ਲਿਮਿਟਡ ਜੋ ਮੋਹਾਲੀ ਵਿਖੇ ਸਥਿਤ ਹੈ ਇਹ ਟੈਲੀਕੋਮਨੇਸ਼ਕੇਸ਼ਨ ਦੀਆਂ ਇਹ ਟੈਲੀਕੋਮਨੀਕੇਸ਼ਨ ਦੀਆਂ ਹਾਰਡਵੇਅਰ ਇਕਯੂਪਮੈਂਟਸ ਬਣਾਉਂਦੀ ਹੈ ਅਤੇ ਦੂਜੀ ਕੰਪਨੀ ਨੂੰ ਸਪਲਾਈ ਕਰਦੀ ਹੈ ਇਹ ਕੰਪਨੀ ਨੈਟਵਰਕਿੰਗ ਦੀ ਬਰੋਡਬੈਂਡ ਜਾਂ ਔਪਟੀਕਲ ਫਾਈਬਰ ਦੇ ਟਰਾਂਸਮਿਸ਼ਨ ਲਈ ਲੋੜੀਂਦਾ ਹਾਰਡਵੇਅਰ ਬਣਾਉਂਦੀ ਹੈ ਬਹੁਤ ਸਾਰੇ ਪਬਲਿਕ ਅਤੇ ਪ੍ਰਾਈਵੇਟ ਕੰਪਨੀਆਂ ਇਸ ਤੋਂ ਇਹ ਟੈਕਨੋਲ ਟਮ ਟੈਲੀਕੋਮਨੀਕੇਸ਼ਨ ਇਕਯੂਪਮੈਂਟ ਲੈਂਦੀਆਂ ਹਨ ਇਹਨਾਂ ਟੈਕਨੋਲੋਜੀ ਪਾਰਕਾਂ ਦੇ ਨਾਲ ਪੰਜਾਬ ਦੀ ਆਰਥ ਅਰਥ ਵਿਵਸਥਾ 'ਤੇ ਵੀ ਬਹੁਤ ਸੁਧਾਰ ਹੋ ਰਿਹਾ ਅਤੇ ਹੋਰ ਛੋਟੀਆਂ ਲੋਕਲ ਕੰਪਨੀਆਂ ਨੂੰ ਨੂੰ ਵੀ ਇਸ ਤੋਂ ਫਾਇਦਾ ਹੋ ਰਿਹਾ